ਜਿਵੇਂ ਸਾਨੂੰ ਪਤਾ ਹੀ ਆ ਕਿ ਰੇਲਵੇ ਲਾਈਨਾਂ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਇਹ ਰੇਲਵੇ ਲਾਈਨਾਂ ਬਾਅਦ ਦੇਸ਼ ਦੇ ਵੱਖ ਵੱਖ ਸ਼ਹਿਰਾਂ 'ਚ ਬਣੀਆਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਰੇਲਵੇ ਲੈਨਾਂ ਅਸੀਂ ਵਪਾਰ ਵਾਸਤੇ ਵਰਤੀਆਂ ਜਿਹਨਾਂ ਨਾਲ ਸਾਡੇ ਦੇਸ਼ ਵਿੱਚ ਬਹੁਤ ਤਰੱਕੀ ਹੋਈ ਸਾਡੇ ਦੇਸ਼ ਦਾ ਸਮਾਨ ਦੂਸਰੇ ਦੇਸ਼ਾਂ ਵਿੱਚ ਜਾਂਦਾ ਰਿਹਾ ਅਤੇ ਦੂਸਰੇ ਦੇਸ਼ਾਂ ਤੋਂ ਅਸੀਂ ਆਪਣੇ ਦੇਸ਼ਾਂ ਵਿੱਚ ਸਮਾਨ ਲਿਆ ਕੇ ਉਸ ਦਾ ਵਪਾਰ ਕਰਦੇ ਰਹੇ ਜਿਸ ਨਾਲ ਸਾਡੇ ਦੇਸ਼ ਦੀ ਬਹੁਤ ਤਰੱਕੀ ਹੋਈ ਵਪਾਰ ਕਰਨ ਨਾਲ ਸਾਡੇ ਦੇਸ਼ ਨੂੰ ਬਹੁਤ ਵਧੀਆ ਪੈਸਾ ਪ੍ਰਾਪਤ ਹੋਇਆ ਜਿਸ ਨਾਲ ਸਾਡਾ ਦੇਸ਼ ਹੋਰ ਵੀ ਤਰੱਕੀ ਵਿੱਚ ਆਇਆ ਜਿਵੇਂ ਬਹੁਤ ਲੋਕਾਂ ਕੋਲ ਰੁਜ਼ਗਾਰ ਘੱਟ ਸੀਗਾ ਅਤੇ ਉਹ ਰੁਜ਼ਗਾਰ ਪ੍ਰਾਪਤ ਕਰਨ ਲਈ ਵੱਖ ਵੱਖ ਸ਼ਹਿਰਾਂ 'ਚ ਦੇਸ਼ਾਂ 'ਚ ਚਲੇ ਗਏ ਅਤੇ ਉਹਨਾਂ ਨੂੰ ਉੱਥੇ ਜਾ ਕੇ ਰੁਜ਼ਗਾਰ ਮਿਲਿਆ ਜੋ ਵੀ ਸਾਡੇ ਦੇਸ਼ ਦੀ ਤਰੱਕੀ ਵਿੱਚ ਆਉਂਦਾ ਇਸੇ ਤਰ੍ਹਾਂ ਹੀ ਹੁਣ ਜਿਵੇਂ ਜਿਵੇਂ ਰੇਲਵੇ ਲਾਈਨਾਂ ਦਾ ਨਿਰਮਾਣ ਹੁੰਦਾ ਹੈ ਉਸੇ ਤਰ੍ਹਾਂ ਹੀ ਤਰੱਕੀ ਵਧਦੀ ਜਾਂਦੀ ਹੈ ਸੋ ਸਾਨੂੰ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਅਤੇ ਦੇਸ਼ ਦੀ ਤਰੱਕੀ ਦਾ ਹਿੱਸਾ ਬਣਨਾ ਚਾਹੀਦਾ ਹੈ ਮੰਨ ਲਓ ਜੇਕਰ ਰੇਲਵੇ ਲਾਈਨਾਂ ਨਾ ਹੁੰਦੀਆਂ ਅਤੇ ਸਾਡੇ ਦੇਸ਼ ਦੂਸਰੇ ਦੇਸ਼ਾਂ ਨਾਲ ਵਪਾਰ ਨਹੀਂ ਸੀ ਕਰ ਸਕਦਾ ਇਸ ਕਰਕੇ ਸਾਨੂੰ ਘੱਟ ਪ੍ਰੋਫਿਟ ਹੋਣਾ ਸੀਗਾ ਧੰਨਵਾਦ